ਮੈਨੂੰ ਅਤੇ ਮੇਰੇ ਪਰਿਵਾਰ ਨੂੰ ਅਖਬਾਰਾਂ ਰਸਾਲੇ ਹੈ ਨਾ ਪੜ੍ਹਨ ਦਾ ਬਹੁਤ ਸ਼ੌਕ ਹੁੰਦਾ ਸੀਗਾ ਪੁਰਾਣੇ ਟਾਈਮ 'ਚ ਤਾਂ ਜਿਹੜੇ ਰਸਾਲੇ ਸੀ ਉਹ ਅਖਬਾਰਾਂ ਦੇ ਨਾਲ ਹੀ ਸਾਨੂੰ ਮਿਲ ਜਾਂਦੇ ਹੁੰਦੇ ਸੀ ਐਤਵਾਰ ਦੀ ਐਤਵਾਰ ਆਏ ਹੁੰਦੇ ਸੀਗੇ ਸਾਡੇ ਘਰੇ ਹੈ ਨਾ ਅਤੇ ਹੁਣ ਦੇ ਸਮੇਂ 'ਚ ਸਾਨੂੰ ਖਰੀਦਣੇ ਪੈਂਦੇ ਹੈ ਹੈ ਨਾ ਅਤੇ ਸ਼ੌਕ ਹੁੰਦਾ ਸੀਗਾ ਪੜ੍ਹਨ ਦਾ ਅਤੇ ਹੁਣ ਵੀ ਖਰੀਦ ਲਈ ਦੇ ਪੜ੍ਹੀ ਦੇ ਆ ਨਿਊਜ਼ ਪੇਪਰ ਜਿਵੇਂ ਅਖਬਾਰ ਉਹ ਹੋ ਗਿਆ ਅਜੀਤ ਦੀ ਹੋ ਗਈ ਹੈ ਨਾ ਜਗ ਬਾਣੀ ਹੋ ਗਈ ਇੱਦਾਂ ਫੇਮਸ ਜਿਹੜੀਆਂ ਅਖਬਾਰਾਂ ਉਹ ਪੜ੍ਹਦੇ ਹੁੰਦੇ ਸੀ ਜ਼ਿਆਦਾਤਰ ਅਸੀਂ ਅਤੇ ਉਹਨਾਂ ਵਿੱਚ ਮੈਨੂੰ ਤਾਂ ਜ਼ਿਆਦਾਤਰ ਚੁਟਕਲੇ ਪੜ੍ਹਨਾ ਪਸੰਦ ਹੁੰਦਾ ਸੀ ਜਾਂ ਫਿਰ ਕਿਸੇ ਵੀ ਨੌਕਰੀ ਦੇ ਬਾਰੇ ਹੈ ਨਾ ਦੱਸਿਆ ਗਿਆ ਹੋਵੇ ਹੈ ਨਾ ਕਿ ਕਿੱਥੇ ਕਿੰਨੀਆਂ ਪੋਸਟਾਂ ਕਿਸ ਚੀਜ਼ ਦੀ ਨੂੰ ਉਹਦੇ ਬਾਰੇ ਕਿਸੇ ਨੇ ਐਡਵਰਟਾਈਜਮੈਂਟ ਦਿੱਤੀ ਹੋਵੇ ਹੈ ਨਾ ਆਪਣੀਆਂ ਚੀਜ਼ਾਂ ਦੀ ਐਡਵੋਟਾਈਜਮੈਂਟ ਦਿੱਤੀ ਹੋਵੇ ਹੈ ਨਾ ਉਹ ਸਾਰੀਆਂ ਚੀਜ਼ਾਂ ਦੇਖਣ ਦਾ ਬੜਾ ਸ਼ੌਕ ਹੁੰਦਾ ਸੀ ਜਾਂ ਕੋਈ ਫਲੈਟ ਵਗੈਰਾ ਹੁੰਦੇ ਸੀ ਹੈ ਨਾ ਕਿ ਫਲੈਟ ਵਿਕਾਉ 'ਤੇ ਹੈ ਇੱਥੇ ਹੈ ਨਾ ਸਾਡੇ ਨਾਲ ਸੰਪਰਕ ਕਰੋ ਉਹ ਚੀਜ਼ਾਂ ਦੇਖਣੀਆ ਹੁੰਦੀਆਂ ਸੀਗੀਆਂ ਬਹੁਤ ਵਧੀਆ ਲੱਗਦਾ ਹੁੰਦਾ ਸੀਗਾ ਪੜ੍ਹਨਾ ਨਿਊਜ਼ ਪੇਪਰ ਅਤੇ ਪਤਾ ਲੱਗਦਾ ਹੁੰਦਾ ਸੀ ਕਿ ਦੁਨੀਆਂ 'ਚ ਕੀ ਹੋ ਰਿਹਾ ਹੈ ਨਾ ਡੇਲੀ ਦੀ ਨਿਊਜ਼ 'ਚ ਅੱਜ ਕਿੱਥੇ ਕੀ ਹੋਇਆ ਕਿੱਥੇ ਐਕਸੀਡੈਂਟ ਹੋਇਆ ਹੈ ਨਾ ਕਿੱਥੇ ਕਿਸ ਚੀਜ਼ ਦਾ ਪ੍ਰੋਗਰਾਮ ਹੋਇਆ ਜਿਹੜੇ ਫੇਮਸ ਹੁੰਦੇ ਸੀ ਹੈ ਨਾ ਅੱਜ ਕੀ ਹੈ ਕਿਸੇ ਗੁ ਸ ਗੁਰੂ ਜੀ ਦਾ ਹੈ ਨਾ ਪ੍ਰਕਾਸ਼ ਪੁਰਬ ਹੈ ਹੈ ਨਾ ਸ਼ਹੀਦੀ ਦਿਹਾੜਾ ਹੈ ਉਹਦੇ ਬਾਰੇ ਸਾਰਾ ਕੁਛ ਨਿਊਜ਼ ਪੇਪਰਾਂ 'ਚ ਆਉਂਦਾ ਹੁੰਦਾ ਸੀ ਛਪ ਕੇ ਕਿ ਅੱਜ ਇਸ ਗੁਰੂ ਸਾਹਿਬਾਨ ਦਾ ਪ੍ਰਕਾਸ਼ ਪੁਰਬ ਹੈ ਅਤੇ ਇਸ ਜਿਹੜਾ ਗੁਰੂ ਸਾਹਿਬ ਹੈ ਉਹਨਾਂ ਦੇ ਸ਼ਹੀਦੀ ਦਿਹਾੜਾ ਹੈ ਅਤੇ ਨਾਲੇ ਤਾਂ ਅਸੀਂ ਆਪਣੇ ਜਿਹੜੇ ਡੇਲੀ ਰੁਟੀਨ ਦੇ ਦੁਨੀਆਦਾਰੀ ਨਾਲ ਜੁੜੇ ਰਹਿੰਦੇ ਸੀ ਸਾਨੂੰ ਪਤਾ ਲੱਗਦਾ ਸੀ ਦੁਨੀਆਦਾਰੀ 'ਚ ਕੀ ਹੁੰਦਾ ਰਹਿੰਦਾ ਸੀ ਅਤੇ ਨਾਲ ਹੀ ਪਤਾ ਲੱਗ ਲੱਗਦਾ ਹੁੰਦਾ ਸੀਗਾ ਹੈ ਨਾ ਕਿ ਕਦੋਂ ਕਿਹੜੇ ਗੁਰੂ ਦਾ ਗੁਰਪੁਰਬ ਹੈ ਕਦੋਂ ਜੋਤੀ ਜੋਤ ਸਮਾਏ ਹੈ ਨਾ ਉਹਨਾਂ ਦਾ ਸ਼ਹੀਦੀ ਦਿਹਾੜਾ ਕਦੋਂ ਹੈ ਹੈ ਨਾ ਇੱਦਾਂ ਸਾਰਾ ਸਾਨੂੰ ਪਤਾ ਲੱਗਦਾ ਰਹਿੰਦਾ ਸੀ ਅਤੇ ਨਿਊਜ਼ 'ਚ ਹੋਰ ਵੀ ਬੜੀਆਂ ਚੀਜ਼ਾਂ ਹੁੰਦੀਆਂ ਸੀ ਇੰਟਰਸਟਿਡ ਪੜ੍ਹਨ ਨੂੰ ਵਿਚਾਰ ਹੁੰਦੇ ਸੀ ਹੈ ਨਾ ਥੋਟਸ ਜਿਹੜੇ ਡੇਲੀ ਦੇ ਆਉਂਦੇ ਹੁੰਦੇ ਸੀ ਵੱਖ ਵੱਖ ਹੁੰਦੇ ਸੀ ਹੈ ਨਾ ਆਪਾਂ ਆਪਣੇ ਕਿ ਕਈਆਂ ਦੇ ਵਧੀਆ ਵਧੀਆ ਉਹ ਨਤੀਜੇ ਦੱਸੇ ਜਾਂਦੇ ਸੀ ਕਈ ਸਾਡੀ ਲਾਈਫ ਨਾਲ ਰਿਲੇਟਡ ਹੁੰਦੇ ਸੀ ਹੈ ਨਾ ਜਿਨ੍ਹਾਂ 'ਤੇ ਸਾਨੂੰ ਬਹੁਤ ਸੋਚਣਾ ਪੈਂਦਾ ਸੀਗਾ ਹੈ ਨਾ ਚਲੋ ਦੁਨੀਆ ਤਾਂ ਚਲਦੀ ਰਹਿਣੀ ਹੈ ਨਾ ਸੋਚਣਾ ਵੀ ਪੈਂਦਾ ਸੀ ਵਧੀਆ ਹੁੰਦੇ ਸੀ ਹੋਰ ਵੀ ਨਿਊਜ਼ ਪੇਪਰ 'ਚ ਬਹੁਤ ਚੀਜ਼ਾਂ ਹੁੰਦੀਆਂ ਸੀ ਪੜ੍ਹਨ ਨੂੰ ਅਤੇ ਮੈਨੂੰ ਤਾਂ ਜ਼ਿਆਦਾਤਰ ਚੁਟਕਲੇ ਪਸੰਦ ਹੁੰਦੇ ਸੀ ਮੈਂ ਚੁਟਕਲੇ ਪੜ੍ਹਦੀ ਹੁੰਦੀ ਸੀ ਬਹੁਤ ਵਧੀਆ ਲੱਗਦਾ ਸੀ ਇਹਨਾਂ ਚੀਜ਼ਾਂ ਨੂੰ ਪੜ੍ਹ ਕੇ ਨਿਊਜ਼ ਪੇਪਰ ਨਾਲ ਜੁੜੇ ਰਹਿਣ ਦੁਨੀਆਦਾਰੀ ਨਾਲ ਅਸੀਂ ਜੁੜੇ ਰਹਿੰਦੇ ਹੁੰਦੇ ਸੀ